ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਹਾਂ ਸਾਡੇ ਪੰਜਾਬ ਦੇ ਸਭਿਆ ਸੱਭਿਆਚਾਰ ਰਵਾਇਤੀ ਪਕਵਾਨ ਵਿੱਚ ਸਾਗ ਢੋਡਿਆਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਸਾਗ ਨੂੰ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਕੇ ਪਹਿਲਾਂ ਬਣਾਉਂਦੇ ਹਾਂ ਫਿਰ ਉਸ ਨੂੰ ਖਾਂਦੇ ਹਾਂ ਔਰ ਉਸ ਵਿੱਚ ਅਸੀਂ ਮੱਖਣ ਪਾ ਕੇ ਬਣ ਖਾਂਦੇ ਹਾਂ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਬੱਚੇ ਜਿਸ ਦੇ ਨਾਲ ਅਸੀਂ ਮੱਕੀ ਦਾ ਮੱਕੀ ਦੀ ਰੋਟੀ ਵੀ ਕਦੀ ਕਦੀ ਚਾਵਲ ਦੀ ਰੋਟੀ ਵੀ ਖਾਣਾ ਪਸੰਦ ਕਰਦੇ ਹਾਂ ਸਾਡੇ ਬੱਚੇ ਜ਼ਿਆਦਾਤਰ ਚਾਵਲ ਦੀ ਰੋਟੀ ਪਸੰਦ ਕਰਨ ਖਾਣਾ ਪਸੰਦ ਕਰਦੇ ਹੈ ਅਸੀਂ ਦਾਲ ਚੌਲ ਅਤੇ ਮਹਾਣੀ ਵੀ ਬਹੁਤ ਜ਼ਿਆਦਾ ਪੰਜਾਬ ਵਿੱਚ ਖਾਣਾ ਪਸੰਦ ਕਰਦੇ ਹੈ ਸਭ ਆਹਾ ਪੰਜਾਬੀ ਲੋਕ ਔਰ ਰਾਜਮਾਂਹ ਚੌਲ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹੈ ਔਰ ਗੁਜਰਾਤ ਵਿੱਚ ਲੋਕ ਡੋ ਡੋਕਲਾ ਵਗੈਰਾ ਔਰ ਜਲੇਬੀ ਫਾਫੜਾ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਕਰਦੇ ਹੈ ਜਦ ਕਿ ਪੰਜਾਬ ਦੀਆਂ ਜ਼ਿਆਦਾ ਫੇਮਸ ਹੈ ਇਹ ਵਾਲੀਆਂ ਚੀਜ਼ਾਂ ਓਕੇ